ਪੰਜਾਬ ਦੇ ਪਿੰਡਾਂ ਦੀ ਜਿਹੜੀ ਪ੍ਰਥਾ ਏ ਉਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਮੁੱਢ ਤੋਂ ਹੀ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਭਾਈਚਾਰਕ ਸਾਂਝ ਰੱਖਦੇ ਨੇ ਜਿਸ ਕਰਕੇ ਉਹਨਾਂ ਨੇ ਕੋਈ ਵੀ ਕੰਮ ਕਾਰ ਕਰਨਾ ਹੁੰਦਾ ਤਾਂ ਉਹ ਆਪਸ ਦੇ ਵਿੱਚ ਮਿਲ ਕੇ ਕਰਦੇ ਨੇ ਇਸੇ ਤਰ੍ਹਾਂ ਜਿਵੇਂ ਲਾਲ ਮਿਰਚਾਂ ਦਾ ਜਿਹੜਾ ਪਾਊਡਰ ਹੈ ਉਹ ਬਣਾਉਣ ਦੇ ਲਈ ਜਿਹੜੀਆਂ ਔਰਤਾਂ ਨੇ ਉਹ ਪਿੰਡਾਂ ਦੇ ਵਿੱਚ ਇਕੱਠੀਆਂ ਹੋ ਜਾਂਦੀਆਂ ਨੇ ਆਪਸੀ ਭਾਈਚਾਰਕ ਸਾਂਝ ਉਹਨਾਂ ਦੇ ਵਿੱਚ ਪਾਈ ਜਾਂਦੀ ਹੈ ਕਿਉਂਕਿ ਇਕੱਠੇ ਮਿਲ ਕੇ ਕੰਮ ਕਾਰ ਕਰਨ ਦਾ ਉਹਨਾਂ ਨੂੰ ਅੱਛਾ ਵੀ ਲੱਗਦਾ ਮਜ਼ਾ ਵੀ ਆਉਂਦਾ ਅਤੇ ਕੰਮ ਵੀ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਏ ਲਾਲ ਮਿਰਚਾਂ ਪੀਸਣ ਦੇ ਲਈ ਉਹ ਜਿਵੇਂ ਵਿਹਲਾ ਸਮਾਂ ਕੋਈ ਵੀ ਹੁੰਦਾ ਤਾਂ ਉਹ ਮਿਥ ਲੈਂਦੀਆਂ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਬੱਚੇ ਜਦੋਂ ਸਕੂਲ ਗਏ ਹੁੰਦੇ ਨੇ ਸਵੇਰ ਦੇ ਸਮੇਂ ਦੇ ਵਿੱਚ ਅਤੇ ਘਰ ਦੇ ਦੂਸਰੇ ਜਿਹੜੇ ਮੈਂਬਰ ਨੇ ਉਹ ਵੀ ਆਪਣੇ ਕੰਮਾਂ ਕਾਰਜਾਂ ਦੇ ਵਿੱਚ ਰੁੱਝੇ ਹੁੰਦੇ ਨੇ ਉਸ ਵੇਲੇ ਉਹ ਇਕੱਠੀਆਂ ਹੋ ਜਾਂਦੀਆਂ ਨੇ ਅਤੇ ਮਾਮ ਦਸਤਾ ਲੈ ਕੇ ਉਹ ਉਹਦੇ ਵਿੱਚ ਮਿਰਚਾਂ ਪੀਸਣ ਦਾ ਜਿਹੜਾ ਕਾਰਜ ਹੈ ਉਹ ਕਰਦੀਆਂ ਨੇ ਮਿਰ ਮਿਰਚਾਂ ਪੀਸਣ ਦੇ ਕਾਰਜ ਦੇ ਨਾਲ ਉਹ ਕੋਈ ਗੀਤ ਛੋਹ ਲੈਂਦੀਆਂ ਨੇ ਜਿਸ ਦੇ ਨਾਲ ਉਹਨਾਂ ਦਾ ਮਨੋਰੰਜਨ ਵੀ ਹੁੰਦਾ ਰਹਿੰਦਾ ਅਤੇ ਨਾਲ ਨਾਲ ਉਹ ਆਪਣਾ ਕੰਮ ਕਾਰ ਹੈ ਜਿਹੜਾ ਉਹ ਮਿਰਚਾਂ ਪੀਸਣ ਵਾਲਾ ਉਹ ਵੀ ਕਰਦੀਆਂ ਰਹਿੰਦੀਆਂ ਨੇ ਅਤੇ ਵਧੀਆ ਤਰੀਕੇ ਦੇ ਨਾਲ ਉਹ ਆਪਣਾ ਕੰਮ ਹੈ ਜਿਹੜਾ ਇਸ ਤਰ੍ਹਾਂ ਨਿਪਟਾ ਲੈਂਦੀਆਂ ਨੇ